ਮੈਨੂੰ ਖੇਤੀਬਾੜੀ ਅਤੇ ਪੌਦੇ ਲਗਾਉਣ ਦਾ ਬਹੁਤ ਸ਼ੌਂਕ ਆ ਕਿਉਂਕਿ ਮੈਂ ਇੱਕ ਕਿਸਾਨ ਫੈਮਿਲੀ ਤੋਂ ਬਿਲੌਂਗ ਕਰਦਾ ਹਾਂ ਅਤੇ ਪੌਦਿਆਂ ਨੂੰ ਮਤਲਬ ਪੈਦਾ ਕਰਨ ਲਈ ਵਧੀਆ ਖਾਦ ਦੀ ਦੀ ਅਤੇ ਮਿੱਟੀ ਦੀ ਲੋੜ ਹੁੰਦੀ ਹੈ ਸਾਨੂੰ ਅਤੇ ਜਿਵੇਂ ਕਿ ਦੇਖਿਆ ਜਾਵੇ ਅੱਜ ਕੱਲ੍ਹ ਰੇਹਾਂ ਸਪਰੇਹਾਂ ਬਹੁਤ ਕੀਤੀਆਂ ਜਾਂਦੀਆਂ ਹਨ ਜੋ ਬਹੁਤ ਨੁਕਸਾਨ ਵੀ ਇਨ੍ਹਾਂ ਦਾ ਨੁਕਸਾਨ ਵੀ ਹੁੰਦਾ ਆ ਅਤੇ ਜਿਵੇਂ ਹੁਣ ਮਿੱਟੀ ਦੀ ਵਰਤੋਂ ਸਾਨੂੰ ਫਸਲਾਂ ਲਈ ਕੀਤੀ ਜਾਂਦੀ ਹੈ ਮਿੱਟੀ ਵੀ ਵੱਖ ਵੱਖ ਹੁੰਦੀਆਂ ਹੈ ਜਿਵੇਂ ਕਿ ਕੈੜੀ ਮਿੱਟੀ ਵੀ ਹੁੰਦੀ ਆ ਬਰੀਕ ਮਿੱਟੀ ਹੁੰਦੀ ਆ ਬਰੀਕ ਮਿੱਟੀ 'ਚ ਫਸਲ ਬਹੁਤ ਵਧੀਆ ਹੁੰਦੀ ਆ ਅਤੇ ਕੈੜੀ 'ਚ ਹੁਣ ਜਿਵੇਂ ਕਿ ਦੇਖਿਆ ਜਾਵੇ ਜ਼ਮੀਨਾਂ ਡਾਕਰ ਨੇ ਉੱਥੇ ਫਸਲ ਵਧੀਆ ਨਹੀਂ ਹੁੰਦੀ ਹੈਗੀ ਇਸ ਕਰਕੇ ਸਾਨੂੰ ਮਿੱਟੀ ਦੀ ਵੀ ਐਨ ਮਤਲਬ ਖੇਤ ਵਧੀਆ ਵਹਾਉਣਾ ਚਾਹੀਦਾ ਆ ਜਿਹਦੇ ਨਾਲ਼ ਫਸਲ ਵਧੀਆ ਹੋਵੇ ਕਿਸਾਨ ਦਾ ਤਾਂ ਕੰਮ ਏ ਆ ਵੀ ਫਸਲ ਵਧੀਆ ਲੈਣ ਕਿਉਂਕਿ ਰੋਜ਼ੀ ਰੋਟੀ ਉਨ੍ਹਾਂ ਦੀ ਉਹੀ ਹੁੰਦੀ ਆ ਜਿਵੇਂ ਕਿ ਫਿਰ ਫਸ ਫਸਲਾਂ 'ਤੇ ਸਾਨੂੰ ਦੇਖਿਆ ਜਾਂਦਾ ਹੈ ਵੀ ਕੀੜੇ ਦੀ ਬਹੁਤ ਬਿਮਾਰੀ ਪੈਂਦੀ ਹੈ ਅਤੇ ਸਾਨੂੰ ਇਨ੍ਹਾਂ ਦੀ ਸਪਰੇਅ ਜ਼ਿਆਦਾ ਨਹੀਂ ਕਰਨੀ ਚਾਹੀਦੀ ਥੋੜ੍ਹੀ ਕਰਨੀ ਚਾਹੀਦੀ ਕਿਉਂਕਿ ਫਿਰ ਨੁਕਸਾਨ ਵੀ ਸਾਨੂੰ ਹੀ ਮਿਲਦਾ ਹੈ ਉਨ੍ਹਾਂ ਦਾ ਸਪਰੇਹਾਂ ਦਾ ਸਾਨੂੰ ਨੇਚੁਰਲ ਰੇਹਾਂ ਦੀ ਰੇਹ ਦੀ ਲੋੜ ਪੈਂਦੀ ਹੈ ਜਿਹੜੀ ਕਿ ਸਾਡਾ ਰੂੜੀ ਹੁੰਦੀ ਆ ਸਾਨੂੰ ਹੋਰ ਕੋਈ ਵੀ ਜ਼ਹਿਰੀਲੀ ਰੇਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਉਨ੍ਹਾਂ ਦਾ ਅਸਰ ਸਾਡੇ 'ਤੇ ਹੀ ਪੈਂਦਾ ਹੈ ਬਾਦ 'ਚ ਬਿਮਾਰੀਆਂ ਲੱਗਦੀਆਂ ਨੇ ਇਸ ਕਰਕੇ ਸਾਨੂੰ ਇਹ ਹੀ ਸਹੀ ਰਹਿੰਦੀ ਹੈ